ਮੇਰਾ ਨਾਮ ਮਮਤਾ ਦੇਵੀ ਹੈ ਮੈਂ ਪਠਾਨਕੋਟ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਜੇ ਮੈਂ ਗੱਲ ਕਰਾਂ ਕਿ ਪੁਰਾਣੇ ਜ਼ਮਾਨੇ ਦੀ ਤਾਂ ਪਹਿਲਾਂ ਲੋਕ ਚੁੱਲ੍ਹੇ 'ਤੇ ਰੋਟੀਆਂ ਬਣਾਇਆ ਕਰਦੇ ਸਨ ਤਾਂ ਜਿਵੇਂ ਸਾਨੂੰ ਪਤਾ ਹੀ ਹੈ ਕਿ ਅੱਜ ਕੱਲ੍ਹ ਦੇ ਜ਼ਮਾਨੇ ਨਾਲ ਸਭ ਕੁਝ ਬਦਲ ਰਿਹਾ ਹੈ ਉਸੇ ਤਰ੍ਹਾਂ ਹੀ ਹੁਣ ਲੋਕ ਚੁੱਲ੍ਹੇ ਦੀ ਥਾਂ ਗੈਸ ਦੀ ਵਰਤੋਂ ਕਰਦੇ ਹਨ ਜਿਸ ਵਿੱਚ ਗੈਸ ਸਿਲੰਡਰ ਦਾ ਇਸਤੇਮਾਲ ਵੀ ਹੁੰਦਾ ਹੈ ਜੇ ਮੈਂ ਗੱਲ ਕਰਾਂ ਚੁੱਲ੍ਹੇ 'ਤੇ ਪਕਾਇਆ ਖਾਣਾ ਉਹ ਸਾਡੇ ਲਈ ਬਹੁਤ ਹੀ ਵਧੀਆ ਹੁੰਦਾ ਸੀ ਕਿਉਂਕਿ ਉਹ ਜ਼ਿਆਦਾ ਤਾਕਤਵਰ ਹੁੰਦਾ ਸੀ ਅਤੇ ਗੈਸ 'ਤੇ ਪਕਾਇਆ ਖਾਣਾ ਉਹ ਸਾਡੇ ਸਰੀਰ ਲਈ ਇੰਨਾਂ ਤਾਕਤਵਰ ਨਹੀਂ ਹੁੰਦਾ ਕਿਉਂਕਿ ਜਿਹੜਾ ਗੈਸ 'ਤੇ ਖਾਣਾ ਬਣਦਾ ਹੈ ਉਹ ਜਲਦੀ ਹੀ ਬਣ ਜਾਂਦਾ ਹੈ ਪਰ ਜਿਹੜਾ ਚੁੱਲ੍ਹੇ 'ਤੇ ਖਾਣਾ ਪਕਾਇਆ ਜਾਂਦਾ ਹੈ ਉਸਨੂੰ ਹੌਲੀ ਹੌਲੀ ਸੇਕ ਲੱਗਦਾ ਹੈ ਅਤੇ ਉਹ ਹੌਲੀ ਹੌਲੀ ਪੱਕ ਜਾਂਦਾ ਹੈ ਪੁਰਾਣੇ ਸਮੇਂ ਵਿੱਚ ਲੋਕ ਹੱਥੀਂ ਕਿਰਤ ਕਰਨਾ ਪਸੰਦ ਕਰਦੇ ਸਨ ਅਤੇ ਲੋਕ ਬਾਲਣ ਗੋਟੇ ਆਦਿ ਬਾਲਦੇ ਸਨ ਅੱਗ ਬਾਲਦੇ ਸਨ ਇਹ ਉਹ ਖਾਣਾ ਬਣਾ ਕੇ ਆਪਣੇ ਹੱਥਾਂ ਦੇ ਨਾਲ ਚੁੱਲ੍ਹੇ 'ਤੇ ਆਪਣੇ ਪਰਿਵਾਰਾਂ ਨੂੰ ਖੁਆਂਦੇ ਸਨ ਹੁਣ ਗੈਸ 'ਤੇ ਖਾਣਾ ਬਣਦਾ ਹੈ ਅਤੇ ਜਿਸ ਕਾਰਨ ਸਾਨੂੰ ਮੰਗਿਆਈ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਇਸ